ਇੱਕ ਕਲਾਕਾਰ ਦੇ ਰੂਪ ਵਿੱਚ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਪਹਿਲੀ ਗੱਲ ਤਾਂ ਮੇਰੇ ਘਰ ਦੇ ਹੀ ਰਾਜ਼ੀ ਨਹੀਂ ਸੀ ਕਿ ਮੈਂ ਇਸ ਕਲਾਕਾਰੀ ਲਾਈਨ ਵਿੱਚ ਆਵਾਂ ਕਿਉਂਕਿ ਮੇਰੇ ਘਰਦਿਆਂ ਨੂੰ ਸੀ ਕਿ ਮੈਂ ਸਾਇੰਸ ਫੀਲਡ ਵਿੱਚ ਜਾਵਾਂ ਮੇਰੇ ਘਰ ਦੇ ਚਾਹੁੰਦੇ ਸੀ ਕਿ ਮੈਂ ਇੱਕ ਵਧੀਆ ਡੌਕਟਰ ਬਣਾ ਔਰ ਉਸ ਤੋਂ ਬਾਅਦ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਕਿਸੇ ਹੋਰ ਫੀਲਡ 'ਚ ਜਾਣਾ ਮੈਨੂੰ ਸਿਰਫ਼ ਕਲਾਕਾਰੀ ਜਾਂ ਗਾਇਕੀ ਹੀ ਪਸੰਦ ਸੀ ਪਹਿਲਾਂ ਤੋਂ ਹੀ ਔਰ ਉਸ ਤੋਂ ਬਾਅਦ ਮੈਂ ਮੇਰੇ ਘਰਦਿਆਂ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਉਹ ਮੰਨ ਵੀ ਗਏ ਉਸ ਵੇਲੇ ਉਸ ਤੋਂ ਬਾਅਦ ਮੈਂ ਕਾਲਜ 'ਚ ਐਡਮਿਸ਼ਨ ਲਿੱਤਾ ਕਾਲਜ 'ਚ ਐਡਮਿਸ਼ਨ ਲੈਂਦਿਆਂ ਹੀ ਮੈਨੂੰ ਪਤਾ ਲੱਗਿਆ ਜਦੋਂ ਮੈਂ ਗਾ ਤਾਂ ਵਧੀਆ ਲੈਂਦਾ ਪਰ ਮੈਨੂੰ ਤਾਲ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤਾਲ ਲਈ ਤਾਂ ਫਿਰ ਇੱਕ ਤਬਲੇ ਦੀ ਜ਼ਰੂਰਤ ਹੁੰਦੀ ਆ ਅਤੇ ਤਬਲਾ ਸਿੱਖਣਾ ਚਾਹਿਆ ਤਬਲਾ ਸਿੱਖਣ ਲਈ ਇੱਕ ਤਬਲਾ ਹੋਣਾ ਬਹੁਤ ਜ਼ਰੂਰੀ ਸੀ ਪਹਿਲਾਂ ਔਰ ਉਸ ਲਈ ਮੈਂ ਮੇਰੇ ਪ੍ਰੋਫੈਸਰ ਨੂੰ ਕਿਹਾ ਕਿ ਮੈਨੂੰ ਤਬਲੇ ਦੀ ਜ਼ਰੂਰਤ ਹੈ ਜੇਕਰ ਤੁਸੀਂ ਤਬਲਾ ਅਰੇਂਜ ਕਰ ਸਕਦੇ ਹੋ ਮੇਰੇ ਲਈ ਬੱਟ ਮੇਰੇ ਪ੍ਰੋਫੈਸਰ ਦਾ ਉਸ 'ਚ ਇਨਕਾਰ ਸੀ ਉਸ ਗੱਲ 'ਚ ਉਹਨਾਂ ਨੇ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਇਸ ਗੱਲ ਦੀ ਜੇਕਰ ਮੇਰੇ ਕੋਲ ਤਬਲਾ ਹੁੰਦਾ ਤਾਂ ਮੈਂ ਅੱਜ ਆਪਣੀ ਇਸ ਕਮੀ ਨੂੰ ਪੂਰੀ ਕਰ ਸਕਦਾ ਸੀ